ਮੇਰੇ ਬੇਟੇ ਨੂੰ ਨਾ ਪੇਂਟਿੰਗ ਦਾ ਸਕੈੱਚ ਵਗੈਰਾ ਬਣਾਉਣ ਦਾ ਬੜਾ ਸ਼ੌਕ ਹੈ ਔਰ ਬਣਾਉਣ ਦੇ ਨਾਲ ਨਾਲ ਉਹਨੂੰ ਖਾਣ ਦਾ ਵੀ ਬਹੁਤ ਸ਼ੌਕ ਹੈ ਇਸ ਤਰ੍ਹਾਂ ਹੀ ਨਾ ਸਕੂਲ ਵਿੱਚ ਉਹਦੇ ਇੱਕ ਪੇਂਟਿੰਗ ਦਾ ਕੰਪਟੀਸ਼ਨ ਸੀ ਉਹਦੇ ਵਿੱਚ ਨਾ ਉਹਨੇ ਪੇਂਟਿੰਗ ਦਾ ਤਾਂ ਸ਼ੌਕ ਸੀ ਖਾਣ ਦੇ ਹੀ ਸ਼ੌਕ ਹੋਣ ਕਰਕੇ ਨਾਲ ਨੂੰ ਉਹਨੇ ਕੇਕ ਦੀ ਪੇਂਟਿੰਗ ਬਣਾ ਤੀ ਔਰ ਉਹਤੇ ਬੜੀ ਅੱਛੀ ਉਹਨੇ ਮਤਲਬ ਪੇਂਟਿੰਗ ਕੀਤੀ ਮਤਲਬ ਅੱਛਾ ਉਹਨੇ ਡਿਜ਼ਾਇਨ ਕੀਤਾ ਸੀ ਉਸ ਚੀਜ਼ ਨੂੰ ਲਿਆ ਕੇ ਉਹਨੇ ਮੈਨੂੰ ਦਿਖਾਇਆ ਕਿ ਮੰਮਾ ਇੰਨਾ ਅੱਛਾ ਕੇਕ ਬਣਾਇਆ ਦੇਖੋ ਜੇ ਇਹ ਸੱਚ ਮੁੱਚ ਇੱਦਾਂ ਹੁੰਦਾ ਤਾਂ ਫਿਰ ਫਿਰ ਮੈਂ ਉਹਨੂੰ ਕੀ ਕੀਤਾ ਮੈਂ ਕਿਹਾ ਚਲੋ ਮੈਨੂੰ ਰੈਸਪੀ ਤਾਂ ਆਉਂਦੀ ਹੈ ਕੇਕ ਦੀ ਚਲੋ ਮੈਂ ਫਿਰ ਉਹਨੂੰ ਕੇਕ ਨੂੰ ਬਣਾਇਆ ਉਹਦੇ ਉੱਤੇ ਵਿੱਚ ਉਹਦੇ ਫੂਟਸ ਵਗੈਰਾ ਪਾਏ ਜੈਲੀਆਂ ਪਾਈਆਂ ਡਰਾਈ ਫਰੂਟ ਪਾਇਆ ਔਰ ਕੇਕ ਡੈਕੋਰੇਸ਼ਨ ਸੇਮ ਉਸ ਤਰ੍ਹਾਂ ਕਰ ਦਿੱਤੀ ਔਰ ਉਹ ਇੰਨਾ ਕੁ ਖੁਸ਼ ਹੋਇਆ ਅਤੇ ਸਭ ਨੇ ਖਾਧਾ ਸਭ ਨੂੰ ਪਸੰਦ ਆਇਆ ਉਸ ਤੋਂ ਬਾਅਦ ਉਹਦਾ ਬਰਡੇ ਆ ਗਿਆ ਅਤੇ ਬਰਡੇ 'ਤੇ ਵੀ ਕਹਿੰਦਾ ਕਿ ਮੰਮਾ ਤੁਸੀਂ ਉਹ ਵਾਲਾ ਹੀ ਕੇਕ ਬਣਾਓ ਮੇਰੇ 'ਤੇ ਉਹਦੇ 'ਤੇ ਕੇਕ ਬਣਾਇਆ ਜਿਹੜੇ ਸਾਡੇ ਰੇਲੈਟਿਵ ਆਏ ਸੀ ਉਹਨਾਂ ਨੇ ਵੀ ਖਾਧਾ ਔਰ ਸਭ ਨੂੰ ਬਹੁਤ ਪਸੰਦ ਆਇਆ ਔਰ ਬਸ ਇਹਦੇ ਨਾਲ ਨਾਲ ਹੁਣ ਜਦੋਂ ਕੋਈ ਰਿਸ਼ਤੇਦਾਰਾਂ ਦਾ ਆਏਗਾ ਆਹ ਵੀ ਉਦੋਂ ਕਹਿਣਗੇ ਮੈਨੂੰ ਤੁਸੀਂ ਬਣਾ ਕੇ ਦਿਓ ਕੇਕ ਜਾਂ ਬੇਟਾ ਵੀ ਕਹੇਗਾ ਫਰੈਂਡਸ ਦਾ ਬਰਡੇ ਆ ਮੰਮਾ ਤੁਸੀਂ ਕੇਕ ਬਣਾ ਕੇ ਦਿਓ ਉਹਨਾਂ ਨੂੰ ਤੁਹਾਡੇ ਹੱਥ ਦਾ ਕੇਕ ਬਹੁਤ ਪਸੰਦ ਆਉਂਦਾ ਔਰ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਹੀ ਉਹਦਾ ਹੁਣ ਮੇਰਾ ਇਹ ਸ਼ੌਕ ਵੀ ਮੇਰਾ ਪੂਰਾ ਹੋ ਜਾਂਦਾ ਅਤੇ ਉਹ ਕੇਕ ਵੀ ਉਹਨਾਂ ਨੂੰ ਉਹਨਾਂ ਦੇ ਮਤਲਬ ਦਾ ਇੱਕ ਘਰ ਦਾ ਫਰੈਸ਼ ਕੇਕ ਮਿਲ ਜਾਂਦਾ ਕਿਉਂਕਿ ਮੈਂ ਕਰੀਮ ਵੀ ਖੁਦ ਤਿਆਰ ਕਰਦੀ ਹਾਂ ਕੇਕ ਉਹਨਾਂ ਨੂੰ ਫਰੈਸ਼ ਮਿਲ ਜਾਂਦਾ ਔਰ ਬਿਨਾਂ ਕੋਈ ਮਿਲਾਵਟ ਤੋਂ ਦੇਖੋ ਨਾ ਬਾਜ਼ਾਰ ਦੇ ਜਿਹੜੇ ਕੇਕ ਹੁੰਦੇ ਆ ਉਹਨਾਂ ਵਿੱਚ ਪ੍ਰੈਜਰੇਟਿਵ ਪਿਆ ਹੁੰਦਾ ਔਰ ਕਾਫੀ ਟਾਈਮ ਤੋਂ ਉਹਨਾਂ ਨੇ ਸਟੋਰ ਕਰਕੇ ਰੱਖਿਆ ਹੁੰਦਾ ਉਸ ਕੇਕ ਨੂੰ ਔਰ ਕਿੰਨੇ ਕਿੰਨੇ ਦਿਨ ਦਾ ਪਿਆ ਹੋਣ ਕਰਕੇ ਉਹ ਜਦੋਂ ਕੋਈ ਕਸਟਮਰ ਆਉਂਦਾ ਉਸੇ ਵੇਲੇ ਉਹਨਾਂ ਨੂੰ ਦੇ ਦਿੰਦੇ ਆ ਔਰ ਮੇਰੀ ਕੀ ਆਦਤ ਹੈ ਕਿ ਮੈਂ ਮੈਂ ਉਹਨਾਂ ਨੂੰ ਕਹਿਣਾ ਕਿ ਜਦੋਂ ਵੀ ਤੁਸੀਂ ਕੇਕ ਦਾ ਔਡਰ ਦੇਣਾ ਮੈਨੂੰ ਥੋੜ੍ਹੇ ਦਿਨ ਪਹਿਲੇ ਇੱਕ ਦੋ ਦਿਨ ਪਹਿਲੇ ਮੈਨੂੰ ਦਿਓ ਦੱਸੋ ਤਾਂ ਕਿ ਮੈਂ ਬਿਲਕੁਲ ਫਰੈਸ਼ ਬਣਾ ਕੇ ਉਹਨਾਂ ਨੂੰ ਦੇਣਾ ਹੁੰਦਾ